ਯੋਗਾ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ ਸਵੇਰੇ ਸਵੇਰੇ ਮੈਂ ਤਾਂ ਇਹ ਹੀ ਕਹਾਂਗਾ ਕਿ ਹਰ ਇਨਸਾਨ ਨੂੰ ਯੋਗੇ ਦੇ ਵਿੱਚ ਹਿੱਸਾ ਜ਼ਰੂਰ ਲੈਣਾ ਚਾਹੀਦਾ ਹੈ ਅੱਜਕੱਲ੍ਹ ਪੰਜਾਬ ਸਰਕਾਰ ਵੱਲੋਂ ਵੀ ਯੋਗੇ ਦੀਆਂ ਕਲਾਸਾਂ ਸਵੇਰੇ ਔਰ ਸ਼ਾਮ ਲਗਾਈਆਂ ਜਾਂਦੀਆਂ ਨੇ ਮੈਂ ਯੋਗੇ ਵਾਸਤੇ ਪਾਰਕ ਦੇ ਵਿੱਚ ਰੋਜ਼ ਜਾਂਦਾ ਔਰ ਮੈਂ ਉੱਥੇ ਦੇਖਦਾਂ ਕਿ ਸੈਂਕੜੋ ਲੋਕ ਉੱਥੇ ਯੋਗੇ ਦੀ ਟ੍ਰੇਨਿੰਗ ਲੈ ਰਹੇ ਹੁੰਦੇ ਹਨ ਔਰ ਜੋ ਕਲਾਸਾਂ ਉਹਨਾਂ ਨੇ ਜੁਆਇਨ ਕੀਤੀਆਂ ਨੇ ਔਰ ਪ੍ਰੋਪਰ ਉਹਦੇ 'ਤੇ ਖਰੇ ਉਤਰ ਵੀ ਰਹੇ ਨੇ ਔਰ ਉਹਨਾਂ ਨੂੰ ਕਾਫ਼ੀ ਹੱਦ ਤੱਕ ਉਸ ਚੀਜ਼ ਦਾ ਫ਼ਾਇਦਾ ਵੀ ਮਿਲਿਆ ਹੈ ਲਾਭ ਵੀ ਲੈ ਰਹੇ ਨੇ ਜਿਨਾਂ ਦੇ ਕਿਸੇ ਵੀ ਤਰ੍ਹਾਂ ਦੀ ਕੋਈ ਮਸਲ ਪੇਨਸ ਜਾਂ ਬੋਡੀ ਦੇ ਵਿੱਚ ਕੋਈ ਵੀ ਉਹਨਾਂ ਨੂੰ ਪ੍ਰੋਬਲਮ ਆ ਰਹੀ ਸੀ ਤਾਂ ਉਹ ਯੋਗੇ ਦੇ ਨਾਲ ਉਹਨਾਂ ਨੂੰ ਕਾਫ਼ੀ ਫ਼ਾਇਦਾ ਮਿਲ ਰਿਹਾ ਔਰ ਇਹ ਆਪਾਂ ਨੂੰ ਹਰ ਕਿਸੇ ਨੂੰ ਕਰਨਾ ਚਾਹੀਦਾ ਹੈ ਧੰਨਵਾਦ